ਹੈਲੋ ਹੈਲੋ ਹਾਂਜੀ ਰਜਨ ਮੈਮ ਗੱਲ ਕਰ ਰਹੇ ਹੋ ਵਧੀਆ ਜੀ ਤੁਸੀਂ ਦੱਸੋ ਮੈਮ ਬੱਸ ਠੀਕ ਠਾਕ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਹੀ ਆ ਮਤਲਬ ਵਿਦਿਆਰਥੀ ਇੱਕ ਅੱਧੇ ਕੁ ਤਾਂ ਗੈਰ ਹਾਜ਼ਰ ਰਹਿੰਦੇ ਆ ਕੁਛ ਇਹ ਆ ਵੀ ਬੈਡ ਹੈਬਿਟਸ ਵਿੱਚ ਜ਼ਿਆਦਾ ਨੇ ਹਾਂਜੀ ਹਾਂਜੀ ਹੋਰ ਦੱਸੋ ਤੁਹਾਡੀ ਕਲਾਸ ਦੇ ਵਿਦਿਆਰਥੀ ਪੂਰੇ ਆਉਂਦੇ ਨੇ ਠੀਕ ਹੈ ਜੀ ਹਾਂਜੀ ਬਾਕੀ ਇਹ ਹੈ ਵੀ ਬੱਚਿਆਂ ਦੇ ਪੇਰੈਂਟਸ ਵੀ ਸ਼ਾਇਦ ਘੱਟ ਧਿਆਨ ਦੇਣ ਕਰਕੇ ਬੱਚੇ ਅਣਗਹਿਲੀ ਕਰਦੇ ਆ ਹਾਂਜੀ ਹਾਂਜੀ ਹਾਂਜੀ ਬਾਕੀ ਇਹ ਹੈ ਵੀ ਪਿੰਡਾਂ ਵਾਲੇ ਬੱਚੇ ਰੂਲ ਘੱਟ ਫੋਲੋ ਕਰਦੇ ਆ ਜਿੰਨਾ ਕੁ ਉਹਨਾਂ ਨੂੰ ਸਕੂਲ 'ਚ ਦੱਸਿਆ ਜਾਵੇ ਉੰਨਾ ਕੁ ਕਰ ਲੈਣ ਤਾਂ ਬਸ ਠੀਕ ਆ ਆ ਪੱਚੀ ਮਈ ਤੋਂ ਕਹਿ ਰਹੇ ਸੀ ਵੀ ਸਾਰੇ ਸਕੂਲਾਂ 'ਚ ਹੋ ਜਾਣੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਨਾ ਹਾਂਜੀ ਹਾਂਜੀ ਬਾਕੀ ਕਹਿ ਰਹੇ ਨੇ ਵੀ ਔਨਲਾਈਨ ਕਲਾਸਾਂ ਜਾਰੀ ਰਹਿਣੀਆਂ ਬੱਚਿਆਂ ਦੇ ਪੇਪਰ ਸਕੂਲ ਸਟਾਰਟ ਹੁੰਦੇ ਸਾਰ ਹੀ ਵੀ ਉਹਨਾਂ ਦੀ ਪੜ੍ਹਾਈ 'ਤੇ ਕੋਈ ਇਕੈਫਟ ਨਾ ਪਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਆ ਵੀ ਜੇ ਬੱਚਿਆਂ ਦਾ ਬਿਲਕੁਲ ਲਿੰਕ ਛੱਡਤਾ ਉਹਨਾਂ ਨਾਲ ਤਾਂ ਇਹ ਹੈ ਵੀ ਉਹਨਾਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ ਇਫੈਕਟ ਪਊਗਾ ਹੋਰ ਜੀ ਸਟਾਫ ਵਧੀਆ ਮਿਲਿਆ ਤੁਹਾਨੂੰ ਨਾਲ ਦੇ ਚਲੋ ਠੀਕ ਹੈ ਮੈਮ